ਹਾਂਜੀ ਹਾਂਜੀ ਬੋਲੋ ਜੀ ਹਾਂਜੀ ਹਾਂਜੀ ਪੜ੍ਹਾਈ ਦੇ ਪੜ੍ਹਾਈ ਦੇ ਨਾਲ ਰਿਲੇਟਡ ਜਾਂ ਫਿਰ ਤੁਸੀਂ ਕੋਈ ਅਦਰ ਐਕਟੀਵਿਟੀਜ਼ ਦੀ ਗੱਲ ਕਰ ਰਹੇ ਹੋ ਅੱਛਾ ਅੱਛਾ ਅੱਛਾ ਤੁਹਾਡੇ ਬੱਚਿਆਂ ਦੀ ਏਜ ਕਿੰਨੀ ਕੁ ਹੈ ਮਤਲਬ ਕਿੰਨੀ ਕੁ ਹੈ ਵੱਡਿਆਂ 'ਚ ਵੱਡੇ ਹੈਗੇ ਕਿ ਥੋੜ੍ਹੇ ਛੋਟੇ ਹੀ ਹੈ ਸਕੂਲ ਸਕੂਲਿੰਗ 'ਚ ਅੱਛਾ ਅੱਛਾ ਆਪਣੇ ਨਾ ਇੱਥੇ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਫਾਜ਼ਿਲਕਾ 'ਚ ਜੇ ਬੱਚਾ ਗੇਮ ਦੇ ਵਿੱਚ ਅੱਛਾ ਹੈ ਨਾ ਫਿਰ ਉਹਦੇ ਲਈ ਇੱਥੇ ਗੇਮਸ ਖੇਡਾਂ ਮੁਕਾਬਲੇ ਵੀ ਕਰਵਾਏ ਜਾਂਦੇ ਹੈ ਵੀ ਉਹਦੇ 'ਚ ਕਈ ਤਰੀਕੇ ਦੀਆਂ ਖੇਡਾਂ ਹੁੰਦੀਆਂ ਵੀ ਜੇ ਬੱਚਾ ਦਿਮਾਗੀ ਤੌਰ 'ਤੇ ਵਧੀਆ ਹੈ ਤਾਂ ਮਤਲਬ ਆਪਣੇ ਸ਼ਤਰੰਜ ਹੋ ਗਈ ਠੀਕ ਹੈ ਅਤੇ ਹੋਰ ਜਿਵੇਂ ਇੰਡੋਰ ਐਕਟੀਵਿਟੀਜ਼ ਹੋ ਗਈਆਂ ਜਿਵੇਂ ਟੈਨਿਸ ਹੋ ਗਿਆ ਅਤੇ ਠੀਕ ਹੈ ਬੈਡਮਿੰਟਨ ਹੋ ਗਿਆ ਅਤੇ ਆਊਟਡੋਰ ਲਈ ਫੁੱਟਬੋਲ ਵੀ ਹੈਗਾ ਬਾਸਕਿਟਵੋਲ ਵੀ ਹੈਗਾ ਅਤੇ ਐਵੇਂ ਦੀਆਂ ਐਕਟੀਵਿਟੀਜ਼ ਹੈਗੀਆਂ ਜੇ ਬੱਚਾ ਖੇਡਾਂ 'ਚ ਲੈਣਾ ਚਾਹੁੰਦਾ ਅਤੇ ਠੀਕ ਹੈ ਹੋਰ ਜੇ ਤੁਸੀਂ ਇਸ ਤੋਂ ਬਿਨਾਂ ਕੋਈ ਐਕਟੀਵਿਟੀ ਦੇਖਣਾ ਚਾਹੁੰਦੇ ਹੋ ਤਾਂ ਹੋ ਗਈ ਜਿਵੇਂ ਆਪਣੀ ਟੈਲੈਂਟਹੰਟ ਹੁੰਦਾ ਉਹਦੇ ਵਿੱਚ ਬੱਚਾ ਆਪਦਾ ਟੈਲੈਂਟ ਦਿਖਾਉਂਦਾ ਅੱਛਾ ਬੱਚਾ ਜਿਵੇਂ ਮਤਲਬ ਜੇ ਡਾਂਸ 'ਚ ਵਧੀਆ ਹੈਗਾ ਤਾਂ ਉਹ ਇੱਥੇ ਡਾਂਸ ਦੇ ਕੋਪੀਟੀਸ਼ਨ ਵੀ ਹੁੰਦੇ ਹੈ ਡਾਂਸ ਦਾ ਵੀ ਮਤਲਬ ਕਰਵਾਏ ਜਾਂਦਾ ਵੀ ਮਤਲਬ ਬੱਚੇ ਦੀ ਡਾਂਸ ਦੀ ਨੂੰ ਅੱਗੇ ਲੈ ਕੇ ਜਾਣ ਲਈ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਅੱਛਾ ਅੱਛਾ ਅਤੇ ਇੱਕ ਆਪਣੇ ਸਿਗਿੰਗ ਵਾਸਤੇ ਵੀ ਹੈਗਾ ਵੀ ਇੱਥੇ ਉਹ ਵੀ ਹੈਗਾ ਰਾਈਸਿੰਗ ਸਟਾਰ ਕਰਕੇ ਹੈਗਾ ਅਤੇ ਬੱਚੇ ਨੂੰ ਉੱਥੇ ਮਤਲਬ ਸਿਰਿੰਗ 'ਚ ਵੀ ਬੱਚਾ ਅੱਗੇ ਜਾਣਾ ਚਾਹੁੰਦਾ ਤਾਂ ਉਹ ਵੀ ਕੋਪੀਟੀਸ਼ਨ ਹੁੰਦੇ ਹੈ ਅਤੇ ਆਪਣੇ ਇੱਥੇ ਹੁੰਦਾ ਵੀ ਜੇ ਰੰਗ ਬੱਚਾ ਜ਼ਿਆਦਾ ਹੈਗਾ ਤਾਂ ਆਰਟ ਐਂਡ ਕਰਾਫਟ ਵੀ ਕਰਵਾ ਦਿੰਦੇ ਉਹਦੇ 'ਚ ਬੱਚੇ ਨੂੰ ਸਿਖਾਇਆ ਜਾਂਦਾ ਕਿ ਵੇਸਟ ਚੀਜ਼ਾਂ ਨੂੰ ਮਤਲਬ ਕਿਵੇਂ ਯੂਟੀਲਾਈਜ਼ ਕਰ ਸਕਦੇ ਹਾਂ ਜਿਵੇਂ ਬੋਟਲਸ ਵਗੈਰਾ ਹੋ ਗਈਆਂ ਠੀਕ ਹੈ ਘਰੇ ਹੋਰ ਸਮਾਨ ਹੁੰਦਾ ਨਾ ਗੱਤੇ ਵਗੈਰਾ ਹੋ ਗਏ ਉਹਨਾਂ ਨਾਲ ਸਹੀ ਇਸਤੇਮਾਲ ਕਿਵੇਂ ਕਰਨਾ ਅਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹਦੇ 'ਚ ਹੋਰ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਅੱਛਾ ਹੋਰ ਆਪਣੀ ਹੈਗੀਆਂ ਇੱਥੇ ਜਿਵੇਂ ਰੰਗੋਲੀ ਹੋ ਗਈ ਜੇ ਤੁਸੀਂ ਰੰਗੋਲੀ ਵਗੈਰਾ ਬਣਾਉਣਾ ਚਾਹੁੰਦੇ ਜੇ ਬੱਚਾ ਪੁਰਾਣੇ ਕਲਚਰ ਦੇ ਨਾਲ ਕੁਛ ਕਰਨਾ ਸਿੱਖਣਾ ਚਾਹੁੰਦਾ ਤਾਂ ਆਪਣੇ ਹੁੰਦਾ ਪਰਾਂਦਾ ਮੇਕਿੰਗ ਹੁੰਦਾ ਜਿਵੇਂ ਪਰਾਂਦਾ ਪਰਾਂਦਾ ਬਣਾਉਣ ਦੇ ਕੋਪੀਟੀਸ਼ਨ ਹੁੰਦੇ ਹੈ ਅਤੇ ਨਾਲਾ ਬਣਾਉਣ ਦੇ ਵੀ ਕੋਪੀਟੀਸ਼ਨਸ ਹੁੰਦੇ ਹੈ ਅਤੇ ਪੀੜ੍ਹੀਆਂ ਹੁੰਦੀਆਂ ਹੈ ਨਾ ਜਿਵੇਂ ਬੈਠਣ ਵਾਲੀਆਂ ਹੁਣ ਤਾਂ ਆਪਣੇ ਖਤਮ ਹੀ ਹੋ ਗਈਆਂ ਇਹ ਚੀਜ਼ਾਂ ਚੇਅਰਸ ਆ ਗਈਆਂ ਤਾਂ ਉਹ ਵੀ ਆਪਣੇ ਇੱਥੇ ਮਤਲਬ ਜੇ ਕੋਈ ਬੱਚਾ ਹੈਗਾ ਤਾਂ ਉਹ ਵੀ ਹੁੰਦਾ ਅਤੇ ਪੱਖੀਆਂ ਬਣਾਉਣ ਦਾ ਕੋਪੀਟੀਸ਼ਨ ਵੀ ਹੁੰਦਾ ਹਾਂਜੀ ਸਭ ਕੁਛ ਹੈਗਾ ਇੱਥੇ ਅਤੇ ਬੱਚਾ ਜੇ ਮਤਲਬ ਉਵੇਂ ਫੈਸ਼ਨ 'ਚ ਅੱਗੇ ਤਾਂ ਫੈਸ਼ਨ ਡਿਜ਼ਾਇਨਿੰਗ ਦਾ ਵੀ ਹੁੰਦਾ ਆਪਣੇ ਇੱਥੇ ਕੋਰਸ ਵੀ ਕਰਵਾਇਆ ਜਾਂਦਾ ਅਤੇ ਬੱਚੇ ਨੂੰ ਉਹ ਵੀ ਕਰਵਾਈ ਜਾਂਦੀ ਹੈ ਵੀ ਕੋਪੀਟੀਸ਼ਨਸ ਵੀ ਹੁੰਦੇ ਹੈ ਬਾਅਦ 'ਚ ਵੀ ਕੌਣ ਵਧੀਆ ਜ਼ਿਆਦਾ ਪ੍ਰਫੋਮ ਕਰੇਗਾ ਹਾਂਜੀ ਓਕੇ ਜੀ ਕੋਈ ਗੱਲ ਨਹੀਂ ਜੀ